ਸਤਿ ਸ਼੍ਰੀ ਅਕਾਲ ਭਾਅ ਜੀ ਰਿਵਾਜ਼ ਹੈਂਡਬੈਗ ਤੋਂ ਗੱਲ ਕਰ ਰਹੇ ਹੋ ਤੁਹਾਡੇ ਕੋਲੋਂ ਲਾਸਟ ਵੀਕ ਇੱਕ ਬੈਗ ਔਡਰ ਕੀਤਾ ਸੀ ਮੈਂ ਹਾਂਜੀ ਹੈਂਡਬੈਗ ਔਡਰ ਕੀਤਾ ਸੀ ਇਹਦੇ ਵਿੱਚ ਬਿਲਕੁਲ ਜੀ ਮਿਲ ਗਿਆ ਹੈ ਬਟ ਇਹਦੇ ਵਿੱਚ ਕਾਫੀ ਸਾਰੀ ਪ੍ਰੋਬਲਮਸ ਹੈ ਇੱਕ ਤਾਂ ਦੇਖੋ ਜੋ ਤੁਸੀਂ ਫੋਟੋ ਦੇ ਵਿੱਚ ਬੈਗ ਦਿਖਾਇਆ ਹੋਇਆ ਸੀ ਬਿਲਕੁਲ ਵੀ ਉਸ ਨਾਲੋਂ ਅਲੱਗ ਹੈ ਪਹਿਲੀ ਗੱਲ ਤਾਂ ਉਹਦਾ ਕਲਰ ਹੀ ਬਿਲਕੁਲ ਅਲੱਗ ਹੈ ਡਿਫਰੈਂਟ ਹੈ ਠੀਕ ਹੈ ਅਤੇ ਦੂਜੇ ਨੰਬਰ 'ਤੇ ਜਿਹੜਾ ਉਸਦੇ ਵਿੱਚ ਤੁਸੀਂ ਉਹ ਦਿਖਾਈਆਂ ਹੋਈਆਂ ਸੀ ਨਾ ਬੈਲਟ ਦਿਖਾਈ ਹੋਈ ਸੀ ਐਨੀ ਮੋਟੀ ਜਿਹੀ ਚੌੜੀ ਜਿਹੀ ਉਹ ਬਿਲਕੁਲ ਪਤਲੀ ਜਿਹੀ ਨਿਕਲੀ ਹੈ ਅਤੇ ਜਿਪਸ ਦੀ ਕੁਆਲਿਟੀ ਵੀ ਬਹੁਤ ਘਟੀਆ ਅੰਦਰ ਜਿਹੜਾ ਕੱਪੜਾ ਲਗਾਇਆ ਹੋਇਆ ਹੈ ਉਹ ਵੀ ਬਹੁਤ ਘਟੀਆ ਕੱਪੜਾ ਲਗਾਇਆ ਹੋਇਆ ਹੈ ਬਿਲਕੁਲ ਉਹ ਖੋਲ੍ਹਦੇ ਹੀ ਐਵੇਂ ਧਾਗੇ ਜਿਹੇ ਨਿਕਲ ਰਹੇ ਉਹਦੇ ਮੈਨੂੰ ਪ੍ਰੋਡਕਟ ਜਿਹੜਾ ਤੁਸੀਂ ਭੇਜਿਆ ਬਹੁਤ ਹੀ ਬੇਕਾਰ ਹੈ ਉਹ ਬਿਲਕੁਲ ਵੀ ਨਹੀਂ ਹੈ ਕਿ ਮੈਂ ਜੋ ਚੀਜ਼ ਦੇਖ ਦੇਖ ਕੇ ਪਸੰਦ ਕੀਤੀ ਸੀਗੀ ਮੈਨੂੰ ਉਹ ਨਹੀਂ ਮਿਲੀ ਹੈ ਨਹੀਂ ਦੂ ਦੂਜਾ ਉਹਦੇ ਵਿੱਚ ਜਿਹੜਾ ਕਲਰ ਹੈ ਗਰੀਨ ਦਿਖਾਇਆ ਹੋਇਆ ਸੀ ਬਰਾਊਨ ਕਲਰ ਭੇਜ ਦਿੱਤਾ ਹੈ ਅਤੇ ਕੁਆਲਿਟੀ ਮਤਲਬ ਉਹਦੀ ਜਿਹੜੀ ਹੈਗੀ ਬਾਹਰ ਸਾਰਾ ਰਿਐਕਸ਼ਨ ਜਿਹਾ ਲੱਗਿਆ ਹੋਇਆ ਲੈਦਰ ਲੈਦਰ ਪਾਇਆ ਹੋਇਆ ਸੀ ਤੁਸੀਂ ਅਤੇ ਉਹ ਕੋਈ ਵੀ ਚੀਜ਼ ਮਤਲਬ ਬਿਲਕੁਲ ਇੱਕ ਵੀ ਚੀਜ਼ ਇਹੋ ਜਿਹੀ ਨਹੀਂ ਮਿਲੀ ਹੈ ਜਿਹੜੀ ਤੁਸੀਂ ਫੋਟੋ 'ਚ ਦਿਖਾਈ ਸੀ ਜਾਂ ਉਹਦਾ ਡਿਸਕ੍ਰਿਪਸ਼ਨ ਦਿੱਤਾ ਹੋਇਆ ਸੀ ਇੱਕ ਵੀ ਚੀਜ਼ ਉਹਦੇ ਵਿੱਚੋਂ ਕੋਈ ਵੀ ਮੈਚ ਨਹੀਂ ਹੋ ਰਹੀ ਹੈ ਕਿ ਕਿਸੇ ਚੀਜ਼ 'ਤੇ ਬੰਦਾ ਐਡਜਸਟਮੈਂਟ ਕਰ ਲਵੇ ਅਤੇ ਹੁਣ ਮੈਂ ਸਿਰਫ ਕੋਲ ਇਸ ਲਈ ਕੀਤੀ ਹੈ ਕਿ ਤੁਸੀਂ ਜਾਂ ਤਾਂ ਮੇਰਾ ਉਹ ਹੈਂਡਬੈਗ ਰੀਪਲੇਸ ਕਰ ਦਿਉ ਪਰ ਰੀਪਲੇਸ ਕਰਕੇ ਮੈਨੂੰ ਸੇਮ ਉਹੀ ਚੀਜ਼ ਚਾਹੀਦੀ ਹੈ ਜੋ ਤੁਸੀਂ ਫੋਟੋ 'ਚ ਦਿਖਾਈ ਹੋਈ ਹੈ ਅਤੇ ਜੋ ਉਹ ਦੀਆਂ ਡਿਟੇਲ ਤੁਸੀਂ ਮੈਨਸ਼ਨ ਕੀਤੀਆਂ ਹੋਈਆਂ ਔਨਲਾਈਨ ਅਤੇ ਜਾਂ ਫਿਰ ਤੁਸੀਂ ਮੇਰੇ ਜਿਹੜੇ ਪੈਸੇ ਵਾਪਸ ਕਰ ਦਿਉ ਹਾਂਜੀ ਮੈਂ ਆਪਣਾ ਜਿਹੜਾ ਤੁਹਾਨੂੰ ਡਿਟੇਲ ਹੈ ਜਿਹੜੀ ਇਸ ਨੰਬਰ 'ਤੇ ਆਪਣੀ ਅਕਾਊਂਟ ਡਿਟੇਲ ਸੈਂਡ ਕਰ ਦਿੰਦੀ ਹਾਂ ਜਿਵੇਂ ਵੀ ਹੈ ਤੁਸੀਂ ਮੈਨੂੰ ਉਵੇਂ ਰਿਸਪੋਸ ਕਰ ਦਿਓ ਧੰਨਵਾਦ ਜੀ